ਸਤਿ ਸ਼੍ਰੀ ਅਕਾਲ ਜੀ ਮੈਂ ਮੇਰੀ ਰੋਲ ਮਾਡਲ ਹੈਗੀ ਹੈ ਮਾਧੁਰੀ ਦਿਕਸ਼ਿਤ ਉਹਨਾਂ ਦੀ ਇੱਕ ਮੂਵੀ ਆਈ ਸੀ ਪਾਰੋ ਜਿਸ 'ਚ ਉਹਨਾਂ ਦਾ ਸੌਂਗ ਸੀਗਾ ਡੋਲਾ ਰੇ ਡੋਲਾ ਰੇ ਡੁਲਾ ਰੇ ਬਹੁਤ ਛੋਟੀ ਸੀ ਅਤੇ ਮੈਨੂੰ ਉਹਨਾਂ ਦਾ ਉਹ ਡਾਂਸ ਇੰਨਾ ਪਸੰਦ ਆਇਆ ਸੀ ਜਿਸ ਵਿੱਚ ਉਹਨਾਂ ਨਾਲ ਐਸ਼ਵਰਿਆ ਰਾਏ ਸੀ ਮੈਨੂੰ ਦੋਨਾਂ ਦਾ ਹੀ ਡਾਂਸ ਬਹੁਤ ਪਸੰਦ ਨੇ ਅਤੇ ਉਹਨਾਂ ਦੇ ਕਾਫੀ ਸਾਰੇ ਗਾਣੇ ਹੈ ਜੋ ਮੈਂ ਬਹੁਤ ਸਿੱਖੇ ਵੀ ਆ ਹੈ ਨਾ ਕਲਾਸਿਜ ਲਿੱਤੀਆਂ ਨੇ ਪਹਿਲਾਂ ਸਕੂਲ ਟਾਈਮ ਕਲਾਸਿਸ ਲਿੱਤੀਆਂ ਨੇ ਜਾ ਕੇ ਅਤੇ ਜਿਵੇਂ ਉਹਨਾਂ ਦਾ ਗਾਣਾ ਸੀ ਝੁਮਕਾ ਗਿਰਾ ਰੇ ਮਾ ਅ ਐਸ਼ਵਰਿਆ ਰਾਏ ਦਾ ਤਾਲ ਸੇ ਤਾਲ ਮਿਲਾ ਇਹਨਾਂ ਦੋਨਾਂ ਨੂੰ ਦੇਖ ਕੇ ਇਹਨਾਂ ਦੇ ਸੌਂਗਸ ਦੇਖ ਕੇ ਮੈਂ ਬਹੁਤ ਸਾਰੇ ਸਟੈਪ ਸਿੱਖਦੀ ਰਹਿੰਦੀ ਹਾਂ ਹੈ ਨਾ ਅਭਿਆਸ ਕਰਦੀ ਰਹਿੰਦੀ ਹਾਂ ਵੀ ਮੈਂ ਇਹਨਾਂ ਦੋਨਾਂ ਵਰਗੀ ਬਣਾ ਅਤੇ ਮੈਨੂੰ ਬਹੁਤ ਸ਼ੌਂਕ ਹੈ ਇਹਨਾਂ ਦੇ ਡਾਂਸ ਫੋਰਮ ਨੂੰ ਹੈ ਨਾ ਕਾਪੀ ਕਰਨ ਦਾ ਬਟ ਮੈਨੂੰ ਉਹਨਾਂ ਦੋਨਾਂ ਵਰਗੀ ਬਣਨ ਦਾ ਵੀ ਬਹੁਤ ਸ਼ੌਂਕ ਹੈ ਇਸ ਲਈ ਮੈਂ ਜਦੋਂ ਵੀ ਹੈ ਨਾ ਆਪਣੇ ਆਪ ਨੂੰ ਪ੍ਰੇਰਿਤ ਕਰਦੀ ਹਾਂ ਤਾਂ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖ ਕੇ ਆਪਣੇ ਆਪ ਨੂੰ ਪ੍ਰੇਰਿਤ ਕਰਦੀ ਹਾਂ ਵੀ ਹਾਂ ਇਹ ਕਿੰਨੀਆਂ ਸੋਹਣੀਆਂ ਲੱਗਦੀਆਂ ਜਾਂ ਫਿਰ ਇਹਨਾਂ ਦੀ ਫਿਟਨੈਸ ਕਿੰਨੀ ਵਧੀਆ ਹੈ ਨਾ ਵੀ ਮੇਰੀ ਵੀ ਫਿਟਨੈਸ ਲਾਈਫ ਇੱਦਾਂ ਹੀ ਹੋਵੇ ਹੈ ਨਾ ਵੀ ਮੈਂ ਵੀ ਇੱਦਾਂ ਦੇ ਡਾਂਸ ਕਰਾਂ ਅਤੇ ਮੈਨੂੰ ਮੇਰੀਆਂ ਦੋਵੇਂ ਇਹਨਾਂ ਦੇ ਕਰਕੇ ਇਹਨਾਂ ਦੀਆਂ ਵੀਡੀਓਜ਼ ਨਾਲ ਔਨਲਾਈਨ ਕਲਾਸਿਜ਼ ਨਾਲ ਮੇਰੇ ਡਾਂਸ 'ਚ ਦਿਨੋ ਦਿਨ ਸੁਧਾਰ ਹੋਇਆ ਅਤੇ ਮੈਂ ਇਹਨਾਂ ਦੇ ਬਹੁਤ ਸਾਰੇ ਸੌਂਗ ਕਾਪੀ ਕਰਦੀ ਹਾਂ ਇਸ ਤੋਂ ਬਾਅਦ ਫਿਰ ਮੈਂ ਪੰਜਾਬੀ ਪੰਜਾਬ 'ਚ ਰਹਿਣ ਕਰਕੇ ਪੰਜਾਬੀ ਸੱਭਿਆਚਾਰ ਕਾਲਜਾਂ ਜਾਂ ਕਿ ਯੂਥ ਫੈਸਟੀਵਲ ਕੀਤੇ ਆ ਜਿਸ ਵਿੱਚ ਮੇਰਾ ਗਿੱਧਾ ਵੀ ਮੇਰਾ ਇੱਕ ਸਟੈਪ ਰਿਹਾ ਜਿਹ 'ਚ ਡਾਂਸ ਹੈ ਜਿਹ 'ਚ ਮੈਂ ਬਹੁਤ ਸਾਰੇ ਡਾਂਸ ਕੀਤੇ ਝੂਮਰ ਡਾਂਸ ਕੀਤਾ ਅਤੇ ਫਿਰ ਮੈਂ ਮਿਸ ਮਾਲਵਾ ਦਾ ਇੱਕ ਕੰਪੀਟੀਸ਼ਨ ਸੀਗਾ ਜਿਹਨੂੰ ਮੈਂ ਇੱਕ ਵਾਰੀ ਹਾਰੀ ਸੀ ਸੈਕਿੰਡ ਟਾਈਮ ਮੈਂ ਉਹਨੂੰ ਜਿੱਤਣਾ ਸੀਗਾ ਅਤੇ ਫਿਰ ਮੈਨੂੰ ਲੱਗਿਆ ਕਿ ਮੈਂ ਇਹ ਨੂੰ ਵਿਨ ਕਰਨਾ ਤਾਂ ਮੈਂ ਬਹੁਤ ਮਿਹਨਤ ਕੀਤੀ ਸੀ ਅਤੇ ਮਤਲਬ ਮੇਰੇ ਅੰਦਰ ਉਹਦਾ ਆਪਣੇ ਆਪ ਨੂੰ ਨਾ ਉਹਨੂੰ ਲੈ ਕੇ ਬਹੁਤ ਜ਼ਿਆਦਾ ਅੰਦਰੋਂ ਜਨੂੰਨ ਪੈਦਾ ਹੋ ਰਿਹਾ ਸੀਗਾ ਵੀ ਮੈਂ ਇਹ ਡਾਂਸ ਸਿੱਖਾਂ ਅਤੇ ਇਹ ਡਾਂਸ ਕਰਾਂ ਅਤੇ ਮੈਂ ਫਿਰ ਉਹਨੂੰ ਵਿਨ ਕੀਤਾ ਇਸ ਤੋਂ ਬਾਅਦ ਫਿਰ ਮੈਂ ਹੁਣ ਆਪਣੀ ਪ੍ਰੈਕਟਿਸ ਕਰਦੀ ਰਹਿੰਦੀ ਹਾਂ ਵੀ ਮੈਂ ਅੱਗੇ ਹੋਰ ਸਾਰੇ ਜਿਵੇਂ ਮਿਸ ਪੰਜਾਬਣ ਵਗੈਰਾ ਦੇ ਜਿਹੜੇ ਕੰਪਟੀਸ਼ਨ ਆਉਂਦੇ ਆ ਉਹਨਾਂ ਵਿੱਚ ਭਾਗ ਲਵਾਂ ਅਤੇ ਲਾਈਫ ਕਦੇ ਸਾਥ ਦੇਵੇ ਤਾਂ ਅੱਗੇ ਵੀ ਆਪਣੇ ਡਾਂਸ ਨੂੰ ਲੈ ਕੇ ਜਾਵਾਂ ਥੈਂਕ ਯੂ